ਮੈਂ ਆਪਣੇ ਘਰ ਵਿੱਚ ਇੱਕ ਬਾਗ ਲਗਾਇਆ ਹੋਇਆ ਬਹੁਤ ਸਾਰੇ ਪੌਦੇ ਲਗਾਏ ਹੋਏ ਤੇ ਅਤੇ ਪੌਦਿਆਂ ਦੀ ਸਿਹਤ ਲਈ ਮੈਂ ਮਾਲੀ ਆਉਂਦਾ ਸਾਡੇ ਘਰ ਕਦੇ ਕਦੇ ਮਾਲੀ ਤੋਂ ਵੀ ਸਲਾਹ ਲੈ ਲੈਂਦੀ ਹਾਂ ਪਰ ਜ਼ਿਆਦਾਤਰ ਮੈਂ ਕੋਸ਼ਿਸ਼ ਕਰਦੀ ਹਾਂ ਕਿ ਗੂਗਲ ਦੇ ਉੱਪਰ ਮੈਂ ਸਰਚ ਕਰ ਲੈਂਦੀ ਹਾਂ ਜਿਹੜਾ ਪੌਦਾ ਮੈਨੂੰ ਐਵੇਂ ਲੱਗਦਾ ਹੈਗਾ ਵੀ ਪੌਦਾ ਥੋੜ੍ਹਾ ਨਰਮ ਹੈ ਵਧੀਆ ਨਹੀਂ ਹੈਗਾ ਹੈ ਨਾ ਮੈਂ ਗੂਗਲ ਤੋਂ ਸਰਚ ਕਰਕੇ ਉਵੇਂ ਉਹਦੇ ਵਿੱਚ ਖਾਦ ਵਗੈਰਾ ਪਾਉਂਦੀ ਹਾਂ ਕੋਸ਼ਿਸ਼ ਕਰਦੀ ਹਾਂ ਉਹਦੀ ਉਹ ਮੈਂ ਦੇਖਭਾਲ ਕਰਦੀ ਹਾਂ ਕਈ ਵਾਰ ਮੈਨੂੰ ਐਂ ਹੁੰਦਾ ਵੀ ਹੋਰ ਪੌਦੇ ਲਗਾਉਣੇ ਨੇ ਕਿ ਕਿਹੜਾ ਪੌਦਾ ਕਿਵੇਂ ਲਗਾਉਣਾ ਕਿਹੜਾ ਪੌਦਾ ਕਿਹੜੀ ਰੁੱਤ 'ਚ ਲਗਾ ਲਗਾਉਣਾ ਚਾਹੀਦਾ ਉਹਦੇ ਬਾਰੇ ਵੀ ਮੈਂ ਸਾਰੇ ਜਾਣਕਾਰੀ ਗੂਗਲ ਤੋਂ ਹੀ ਲੈਂਦੀ ਹਾਂ ਗੂਗਲ 'ਤੇ ਕਈ ਅਹੀਆ ਜ ਐਪਸ ਹੈਗੀਆਂ ਜਿਹੜੀਆਂ ਪੌਦੇ ਦੀ ਦੇਖਭਾਲ ਕਰਨ ਵਿੱਚ ਬਹੁਤ ਸਾਰੀ ਮਦਦ ਕਰਦੀਆਂ ਨੇ ਇਸ ਲਈ ਮੈਂ ਜ਼ਿਆਦਾਤਰ ਸਲਾਹ ਗੂਗਲ ਤੋਂ ਹੀ ਲੈਂਦੀ ਹਾਂ ਪਰ ਕਈ ਵਾਰ ਜਦੋਂ ਮਾਲੀ ਆ ਜਾਂਦਾ ਮਾਲੀ ਜਿਵੇਂ ਇੱਕ ਮਤਲਬ ਕਿ ਇਨਸਾਨ ਦਾ ਜਿਹੜਾ ਡਾਕਟਰ ਹੁੰਦਾ ਉਹ ਦੇਖ ਉਹਨੂੰ ਪਤਾ ਹੁੰਦਾ ਇਨਸਾਨ ਬਾਰੇ ਵੀ ਇਹਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਕਿਹੜੀ ਕਮੀ ਹੈ ਇਹਦੇ 'ਚ ਇਸੇ ਤਰ੍ਹਾਂ ਹੀ ਕਈ ਵਾਰ ਮੈਂ ਮਾਲੀ ਨੂੰ ਵੀ ਦਿਖਾ ਦਿੰਦੀ ਹਾਂ ਮਾਲੀ ਸ ਇਹ ਪੌਦਾ ਥੋੜ੍ਹਾ ਨਰਮ ਕਿਉਂ ਹੈ ਕਿਵੇਂ ਕਦੋਂ ਚੱਲੂਗਾ ਤਾਂ ਮਾਲੀ ਵੀ ਵਧੀਆ ਸਲਾਹ ਦਿੰਦਾ ਇਹਨੂੰ ਐਵੇਂ ਇਸ ਇਸਦੀ ਐਵੇਂ ਕਟਿੰਗ ਕਰ ਦਿਓ ਇਹਨੂੰ ਐਵੇਂ ਪਾਣੀ ਦੇ ਦਿਓ ਇਸਨੂੰ ਖਾਦ ਦੀ ਜ਼ਰੂਰਤ ਹੈ ਇਸ ਨੂੰ ਗੁਡਾਈ ਦੀ ਜ਼ਰੂਰਤ ਹੈ ਇਸਨੂੰ ਪਾਣੀ ਦੀ ਘਾਟ ਹੈ ਸਾਰੀ ਸਲਾਹ ਮਾਲੀ ਤੋਂ ਵੀ ਲੈ ਲੈਂਦੀ ਹਾਂ ਜ਼ਿਆਦਾਤਰ ਗੂਗਲ ਹੈ ਜੋ ਬਹੁਤ ਵਧੀਆ ਹੈ ਆਪਣੇ ਪੌਦਿਆਂ ਦੀ ਬਿਹਤਰ ਸਿਹਤ ਲਈ ਜੇ ਆਪਾਂ ਸਲਾਹ ਲੈਣੀ ਹੋਵੇ ਤਾਂ ਗੂਗਲ 'ਤੇ ਬਹੁਤ ਸਾਰੀਆਂ ਐਪਸ ਨੇ ਬਹੁਤ ਸਾਰਾ ਭੰਡਾਰ ਪਿਆ ਹੈ ਜੇ ਆਪਾਂ ਉਹਨਾਂ ਤੋਂ ਜਾਣਕਾਰੀ ਲੈਣੀ ਹੋਵੇ ਆਪਣੇ ਪੌਦਿਆਂ ਬਾਰੇ ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਮੈਂ ਇੱਕ ਬਹੁਤ ਸੁੰਦਰ ਸੋਹਣਾ ਹਰਿਆ ਭਰਿਆ ਬਾਗ ਤਿਆਰ ਕੀਤਾ ਹੋਇਆ ਹੈ